ਪੰਜਾਬ ਦੇ ਵਿੱਚ ਵੈਸੇ ਤਾਂ ਪੰਜਾਬੀ ਬਹੁਤ ਸਾਰੇ ਤਿਉਹਾਰ ਮਨਾਉਂਦੇ ਹਨ ਅਤੇ ਬਹੁਤ ਸਾਰੇ ਤਿਉਹਾਰਾਂ ਦੇ ਵਿੱਚ ਸ਼ਾਮਲ ਵੀ ਹੁੰਦੇ ਹਨ ਪਰ ਜੇਕਰ ਆਪਾਂ ਪੰਜਾਬ ਦੇ ਵਿੱਚ ਮਨਾਏ ਜਾਣ ਵਾਲੇ ਮੁੱਖ ਸੱਭਿਆਚਾਰਕ ਤਿਉਹਾਰਾਂ ਦੀ ਗੱਲ ਕਰੀਏ ਤਾਂ ਉਸ ਵਿੱਚ ਸਭ ਤੋਂ ਪਹਿਲਾਂ ਨਾਂ ਤਾਂ ਗੁਰਪੁਰਬ ਦੀਵਾਲੀ ਦੁਸਹਿਰਾ ਲੋਹੜੀ ਅਤੇ ਵਿਸਾਖੀ ਦਾ ਆਉਂਦਾ ਹੈ ਜੇਕਰ ਆਪਾਂ ਗੱਲ ਕਰੀਏ ਗੁਰਪੁਰਬ ਦੀ ਤਾਂ ਪੰਜਾਬ ਦੇ ਵਿੱਚ ਮਨਾਉਣ ਵਾਲਾ ਇਹ ਬਹੁਤ ਪ੍ਰਸਿੱਧ ਤਿਉਹਾਰ ਹੈ ਜਿਸ ਵਿੱਚ ਗੁਰ ਸ਼੍ਰੀ ਗੁਰੂ ਜੀ ਦੇ ਜਨਮ ਅਤੇ ਸ਼ਹੀਦੀ ਦਿਵਸ ਦਾ ਦਿਨ ਮਨਾਇਆ ਜਾਂਦਾ ਹੈ ਜੇਕਰ ਆਪਾਂ ਗੱਲ ਕਰੀਏ ਲੋਹੜੀ ਦੀ ਤਾਂ ਲੋਹੜੀ ਤੇਰ੍ਹਾਂ ਜਨਵਰੀ ਨੂੰ ਮਨਾਈ ਜਾਂਦੀ ਹੈ ਜਿਸ ਪ੍ਰਾਂਤ ਪੰਜਾਬ ਦੇ ਵਿੱਚ ਹੋਏ ਮੁੰਡਿਆਂ ਦੇ ਘਰ ਲੋਹੜੀ ਜ਼ਿਆਦਾ ਸ਼ੌਂਕ ਨਾਲ ਮਨਾਈ ਜਾਂਦੀ ਹੈ ਅਤੇ ਢੋਲ ਢੱਪੇ ਨਾਲ ਆਹਾ ਮਨਾਈ ਜਾਂਦੀ ਹੈ ਜੇਕਰ ਆਪਾਂ ਗੱਲ ਕਰੀਏ ਵਿਸਾਖੀ ਦੀ ਵਿਸਾਖੀ ਪੰਜਾਬ ਦੀ ਫਸਲ ਦੇ ਪੱਕਣ ਤੋਂ ਬਾਅਦ ਮਨਾਈ ਜਾਂਦੀ ਹੈ ਕਿਸਾਨ ਪੰਜਾਬ ਦੇ ਵਿੱਚ ਖੁਸ਼ੀ ਨਾਲ ਆਪਣੀ ਵਿਸਾਖੀ ਮਨਾਉਂਦੇ ਹਨ ਆਪਣੀ ਖੁਸ਼ੀ ਜੋ ਫਸਲ ਪੱਕਣ ਤੋਂ ਬਾਅਦ ਹੁੰਦੀ ਹੈ ਉਸ ਨੂੰ ਵਿਸਾਖੀ ਦੇ ਰਾਹੀਂ ਮਨਾਉਣ ਦੇ ਰਾਹੀਂ ਉਹ ਹੈ ਅਤੇ ਆਪਾਂ ਗੱਲ ਕਰੀਏ ਦੀਵਾਲੀ ਦੀ ਤਾਂ ਦੀਵਾਲੀ ਵੀ ਬਹੁਤ ਹਰਸ਼ ਉਲਾਸ ਨਾਲ ਪੰਜਾਬ ਦੇ ਵਿੱਚ ਮਨਾਈ ਜਾਂਦੀ ਹੈ